ਜਿਵੇਂ ਕਿ ਮੇਰਾ ਗਾਉਣਾ ਸ਼ੌਂਕ ਹੈ ਤਾਂ ਇਸ ਸਬੰਧੀ ਮੈਂ ਦੱਸਣਾ ਚਾਹੁੰਨਾ ਹਾਂ ਵੀ ਜਿਵੇਂ ਜਿਹੜਾ ਬੰਦਾ ਬਹੁਤ ਸ਼ੁਰੂਆਤ ਵਿੱਚ ਗਾਉਣ ਲੱਗਦਾ ਤਾਂ ਉਹਦਾ ਸਾਹ ਚੜ ਜਾਂਦਾ ਉਹ ਸਾਹ ਚੜਨ ਦਾ ਜਿਹੜਾ ਹੈਗਾ ਹੈ ਉਹ ਸ਼ੁਰੂ ਸ਼ੁਰੂ ਵਿੱਚ ਸਾਹ ਜ਼ਰੂਰ ਚੜਦਾ ਹੈ ਅਤੇ ਉਹਨੂੰ ਦੂਰ ਕਰਨ ਵਾਸਤੇ ਸਾਨੂੰ ਨਿਰੰਤਰ ਉਹਦੇ ਵਿੱਚ ਸਾਨੂੰ ਗਾਉਣ ਵੱਲ ਮਤਲਬ ਸਾਨੂੰ ਅਭਿਆਸ ਕਰਨਾ ਪੈਂਦਾ ਜਿੰਨਾ ਅਭਿਆਸ ਕਰੀ ਜਾਊਗੇ ਤਾਂ ਸਾਨੂੰ ਗਾਉਣ ਵਿੱਚ ਸਹਾਇਤਾ ਮਿਲਦੀ ਰਹੂਗੀ ਅਤੇ ਸਾਡਾ ਜਿਹੜਾ ਅਭਿਆਸ ਕਰਨ ਨਾਲ ਗਾਉਣ ਦਾ ਜਿਹੜਾ ਟਾਈਮ ਹੈ ਸਮਾਂ ਹੈ ਉਹ ਬਹੁਤ ਜ਼ਿਆਦਾ ਵਾਧਾ ਰਹੂਗਾ ਜਿੰਨਾ ਆਪਾਂ ਰੋਜ਼ ਜ਼ਿਆਦਾ ਅਭਿਆਸ ਕਰਾਂਗੇ ਉਨਾ ਜ਼ਿਆਦਾ ਸਾਡਾ ਜਿਹੜਾ ਇੱਕ ਤਾਂ ਗਾਇਨ ਵਿੱਚ ਰੁਚੀ ਵੱਧ ਆਊਗੀ ਅਤੇ ਉਹਦੇ ਵਿਚਲੀਆਂ ਜਿਹੜੀਆਂ ਗਲਤੀਆਂ ਦੂਰ ਹੁੰਦੀਆਂ ਰਹੂੰਗੀਆਂ ਜਿੰਨਾ ਤੁਸੀਂ ਇਹਨੂੰ ਸਵੇਰੇ ਉੱਠ ਕੇ ਕਰੋਗੇ ਉਨਾ ਜ਼ਿਆਦਾ ਇਹਦੇ ਵਿੱਚ ਨਿ ਨਿਖਰੂਗਾ ਤੁਹਾਡਾ ਗਾਇਨ ਅਤੇ ਇਸ ਵਿੱਚ ਸੁਧਾਰ ਹੋਊਗਾ